ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਮੈਂ ਭਾਈ ਗੁਰਦਾਸ ਲਾਇਬ੍ਰੇਰੀ ਤੋਂ ਲਾਇਬ੍ਰੇਰੀਅਨ ਬੋਲ ਰਿਹਾ ਜੀ ਧੰਨਵਾਦ ਜੀ ਤੁਸੀਂ ਆਪਣੀ ਜਿਹੜੀ ਇਹ ਤੁਹਾਡੀ ਸ਼ਿਕਾਇਤ ਹੈਗੀ ਆ ਉਹ ਤੁਸੀਂ ਮੈਨੂੰ ਇਸ ਬਾਰੇ ਜਾਣਕਾਰੀ ਦਿੱਤਾ ਦਿੱਤੀ ਅਤੇ ਮੈਂ ਇਸ ਸੰਬੰਧੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਥੋਂ ਤੱਕ ਸਫ਼ਾਈ ਨਾਲ਼ ਜਾਂ ਹੋਰ ਹੋਰ ਕੁਰਸੀਆਂ ਦੀ ਅਰੇਂਜਮੈਂਟ ਨਾਲ਼ ਸੰਬੰਧਿਤ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਉਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਮੇਨ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਕਿ ਜਿਹੜਾ ਸਫ਼ਾਈ ਵਾਲਾ ਬੰਦਾ ਸੀ ਉਹ ਬਿਮਾਰ ਹੋਣ ਕਰਕੇ ਛੁੱਟੀ 'ਤੇ ਸੀ ਇਸ ਕਰਕੇ ਇਹ ਦਿੱਕਤ ਜ਼ਿਆਦਾ ਵਿਦਿਆਰਥੀਆਂ ਨੂੰ ਮਹਿਸੂਸ ਹੋਈ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਸ 'ਤੇ ਕੋਈ ਹੋਰ ਵੱਖਰੇ ਪ੍ਰਬੰਧ ਕਰਾਂਗੇ ਕਿ ਅਗਰ ਕੋਈ ਬੰਦਾ ਛੁੱਟੀ 'ਤੇ ਆ ਤਾਂ ਉਹਦੇ ਥਾਂ 'ਤੇ ਕੋਈ ਹੋਰ ਬੰਦਾ ਆ ਜਾਵੇ ਅਤੇ ਇਸ ਤੋਂ ਇਲਾਵਾ ਜਿੱਥੋਂ ਤੱਕ ਕਿ ਕਿਤਾਬਾਂ ਨੂੰ ਲੱਭਣ ਬਾਰੇ ਜਾਂ ਹੋਚਪੋਚ ਹੋਣ ਬਾਰੇ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਵੀ ਅਸੀਂ ਔਨਲਾਈਨ ਸਿਸਟਮ ਕਰ ਦਿੱਤਾ ਅਤੇ ਅੱਗੇ ਤੋਂ ਇਹ ਕੰਮ ਨਹੀਂ ਹੋਵੇਗਾ ਜੀ ਠੀਕ ਹੈ ਜੀ ਥੈਂਕ ਥੈਂਕ ਯੂ ਜੀ